ਹਾਂਜੀ ਅੱਜ ਕੱਲ੍ਹ ਜਿਹੜੀ ਤਕਨਾਲੋਜੀ ਸਾਡੀ ਬਹੁਤ ਜ਼ਿਆਦਾ ਵਿਕਸਤ ਹੋ ਰਹੀ ਹੈ ਉਸ ਨੇ ਬੈਂਕਿੰਗ ਨੂੰ ਵੀ ਬਹੁਤ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਕਿਉਂਕਿ ਪਹਿਲਾਂ ਦੇ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੋਰਮੈਲਟੀਸ ਹੀ ਬਹੁਤ ਜ਼ਿਆਦਾ ਹੁੰਦੀਆਂ ਸੀ ਲੋਕਾਂ ਨੂੰ ਜਾ ਕੇ ਬੈਂਕਾਂ ਦੇ ਕਈ ਕਈ ਚੱਕਰ ਲਗਾਉਣੇ ਪੈਂਦੇ ਸੀ ਤਾਂ ਜਾ ਕੇ ਉਹਨਾਂ ਦਾ ਕੋਈ ਬੈਂਕ ਦੇ ਵਿੱਚ ਜਾ ਕੇ ਕੰਮ ਹੁੰਦਾ ਸੀ ਇੱਕ ਕੰਮ ਲਈ ਹੀ ਉਹਨਾਂ ਨੂੰ ਕਈ ਚੱਕਰ ਲਗਾਉਣੇ ਪੈਂਦੇ ਸੀ ਲੇਕਿਨ ਹੁਣ ਜੋ ਹੈ ਤੁਸੀਂ ਘਰ ਬੈਠੇ ਬੈਠੇ ਹੀ ਆਪਣੇ ਤੁਸੀਂ ਫੋਨ ਦੇ ਥਰੂ ਕਿਸੇ ਵੀ ਐਪ ਦੇ ਥਰੂ ਆਪਣਾ ਜਿਹੜਾ ਹੈਗਾ ਕੋਈ ਵੀ ਕੰਮ ਤੁਸੀਂ ਉਸੇ ਟਾਈਮ ਕਰਵਾ ਸਕਦੇ ਹੋ ਜਿਵੇਂ ਕਿ ਤੁਸੀਂ ਕਿੰਨੇ ਜ਼ਿਆਦਾ ਤੁਸੀਂ ਵੇਖ ਲੋਲਉ ਕਿ ਤੁਸੀਂ ਚਾਹੇ ਕੋਈ ਬਿਲ ਪੇਅ ਕਰਨਾ ਹੈ ਜਾਂ ਫਿਰ ਤੁਸੀਂ ਕੋਈ ਆਪਣੇ ਪੈਸੇ ਬੈਂਕ ਤੋਂ ਨਿਕਲਵਾਉਣੇ ਹਨ ਜਾਂ ਫਿਰ ਕੋਈ ਤੁਸੀਂ ਚੀਜ਼ ਆਪਾਂ ਨੇ ਖਰੀਦੀ ਹੈ ਉਸ ਦਾ ਤੁਸੀਂ ਉਸ ਨੂੰ ਉਸੇ ਟਾਈਮ ਤੁਸੀਂ ਮਤਲਬ ਬਿਲ ਜਿਹੜਾ ਹੈਗਾ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਨੂੰ ਜਿਹੜਾ ਸੁ ਸੁਵਿਧਾਵਾਂ ਮਿਲ ਰਹੀਆਂ ਹਨ ਇਹ ਸਾਰਾ ਕੁਝ ਇਹ ਤਕਨਾਲੋਜੀ ਦੀ ਹੀ ਦੇਣ ਹੈ ਅਤੇ ਜੇ ਇਹਦੇ ਵਿੱਚ ਕੋਈ ਮਨੁੱਖੀ ਦਖਲ ਅੰਦਾਜ਼ੀ ਦੀ ਜਿਹੜੀ ਘਾਟ ਹੈ ਉਸ ਦੇ ਕਰਕੇ ਥੋੜ੍ਹੀ ਬਹੁਤੀ ਸ਼ੁਰੂ ਸ਼ੁਰੂ ਦੇ ਵਿੱਚ ਕੋਈ ਮਤਲਬ ਉਲਝਣ ਆਈ ਵੀ ਸੀ ਤਾਂ ਮਤਲਬ ਉਹ ਸਿਰਫ ਜਿਹਨਾਂ ਨੂੰ ਥੋੜ੍ਹੀ ਜੀ ਨੌਲਜ ਘੱਟ ਹੁੰਦੀ ਹੈ ਜਾਣਕਾਰੀ ਘੱਟ ਹੁੰਦੀ ਹੈ ਉਹਨਾਂ ਦੇ ਲਈ ਸੀ ਲੇਕਿਨ ਹੁਣ ਉਹ ਜਿਹਨਾਂ ਨੂੰ ਜ਼ਿਆਦਾ ਥੋੜ੍ਹੀ ਜਾਣਕਾਰੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਉਹ ਉਲਝਣਾਂ ਵੀ ਜਿਹੜੀਆਂ ਹੈਗੀਆਂ ਬਿਲਕੁਲ ਵੀ ਉਹ ਤੰਗ ਨਹੀਂ ਕਰਦੀਆਂ ਉਹਨਾਂ ਨੂੰ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੁਵਿਧਾਵਾਂ ਦਾ ਸੁੱਖ ਹੀ ਮਿਲਦਾ ਹੈ